ਜਦ ਮੈਂ ਪਹਿਲੀ ਵਾਰ ਕੁਛ ਬਣਾਉਂਦੀ ਹਾਂ ਤਾਂ ਯੂਟਿਊਬ ਤੋਂ ਦੇਖ ਲੈਂਦੀ ਹਾਂ ਠੀਕ ਆ ਯੂਟਿਊਬ 'ਤੇ ਹਰ ਇੱਕ ਤਰ੍ਹਾਂ ਦੀ ਰੈਸਪੀ ਹੈ ਕਿੱਦਾਂ ਤੁਸੀਂ ਬਣਾਉਣਾ ਕਿੰਨਾ ਕੁ ਪਾਉਣਾ ਕਿਆ ਕਰਨਾ ਸਾਰਾ ਕੁਝ ਯੂਟੀਊਬ 'ਤੇ ਲਿਖਣਾ ਕਿਸੇ ਮੇਰਾ ਤਜ਼ਰਬਾ ਕਹਿੰਦਾ ਕਿ ਯੂਟਿਊਬ ਤੋਂ ਦੇਖੋ ਯੂਟਿਊਬ ਤੋਂ ਦੇਖ ਕੇ ਬਣਾ ਲਵਾਂ ਬਣਾ ਕੇ ਨਹੀਂ ਬਣਿਆ ਫਿਰ ਅਭਿਆਸ ਕਰ ਲੈਂਦੀ ਹਾਂ ਫਿਰ ਬਣਾ ਲੈਂਦੀ ਹਾਂ ਇੱਕ ਵਾਰੀ ਨਹੀਂ ਬਣਦਾ ਦੂਜੀ ਵਾਰ ਤਾਂ ਬਣ ਹੀ ਜਾਂਦਾ ਇਸ ਤਰ੍ਹਾਂ ਕਰਕੇ ਫਿਰ ਮੈਂ ਜਿਹੜੇ ਆਪਣੇ ਪਹਿਲੀ ਵਾਰ ਕੋਈ ਵੀ ਪਕਵਾਨ ਬਣਾਉਂਦੀ ਹਾਂ ਕੋਈ ਵੀ ਵਿਅੰਜਨ ਬਣਾਉਂਦੀ ਹਾਂ ਤਾਂ ਉਥੋਂ ਬਣਾ ਲੈਂਦੀ ਹਾਂ ਯੂਟਿਊਬ ਤੋਂ ਦੇਖ ਕੇ